ਭਾਰਤ ਵਿੱਚ ਕਈ ਤਰ੍ਹਾਂ ਦੀਆਂ ਭਾਸ਼ਾਵਾਂ ਪਾਈਆ ਜਾਂਦੀਆਂ ਹਨ ਜਿਸ ਤਰ੍ਹਾਂ ਪੰਜਾਬੀ ਹਿੰਦੀ ਉਰਦੂ ਫਾਰਸੀ ਨੇਪਾਲੀ ਗੁਜਰਾਤੀ ਕਈ ਤਰ੍ਹਾਂ ਦੀਆਂ ਭਾਸ਼ਾਵਾਂ ਨੇ ਜਿਸ ਤਰ੍ਹਾਂ ਕਿ ਮੈਂ ਵੀ ਹਿੰਦੀ ਅਤੇ ਪੰਜਾਬੀ ਦੇ ਵਿੱਚ ਭਾਸ਼ਾ ਦੇ ਵਿੱਚ ਫ਼ਰਕ ਤੁਲਨਾ ਕਰਨਾ ਚਾ ਦੱਸਣਾ ਚਾਹੁੰਦੀ ਹਾਂ ਹਿੰਦੀ ਅਤੇ ਪੰਜਾਬੀ ਵਿੱਚ ਕਈ ਚੀਜ਼ਾਂ ਤਾਂ ਇਸ ਤਰ੍ਹਾਂ ਜਿਹੜੀਆਂ ਬਿਲਕੁਲ ਸੇਮ ਹੁੰਦੀਆਂ ਨੇ ਕਈ ਵਰਡ ਬੋਲਣ ਅਤੇ ਬੋਲਣ ਵਿੱਚ ਦੋਨੋਂ ਸੇਮ ਹੀ ਨੇ ਕੁਝ ਨੇ ਜਿਹਨਾਂ ਵਿੱਚ ਥੋੜ੍ਹਾ ਫ਼ਰਕ ਹੈਗਾ ਹੈ ਜਿਸ ਤਰ੍ਹਾਂ ਕਿ ਤੁਸੀਂ ਆਪ ਉਹ ਵੋਹ ਇਹ ਯੇਹ ਇੱਥੇ ਜਹਾਂ ਉੱਥੇ ਵਹਾਂ ਇਸ ਤਰ੍ਹਾਂ ਹਿੰਦੀ ਅਤੇ ਪੰਜਾਬੀ ਵਿੱਚ ਕਾਫ਼ੀ ਬੋਲਣ ਵਿੱਚ ਬੋਲਣ ਵਿੱਚ ਤਾਂ ਜ਼ਿਆਦਾ ਫ਼ਰਕ ਨਹੀਂ ਹੈ ਪਰ ਲਿਖਣ ਵਿੱਚ ਕਈ ਥਾਵਾਂ 'ਤੇ ਥੋੜਾ ਬਹੁਤਾ ਫ਼ਰਕ ਹੈ ਕਈ ਅੱਜ ਦੇ ਸਮੇਂ ਵਿੱਚ ਹਿੰਦੀ ਅਤੇ ਪੰਜਾਬੀ ਦੋਨੋਂ ਸੇਮ ਹੀ ਹੋ ਗਏ ਨੇ ਕੁਝ ਹੀ ਅੰਤਰ ਰਹਿ ਗਿਆ ਹੈ ਦੋਂਨੋ ਭਾਸ਼ਾਵਾਂ ਦੇ ਵਿੱਚ